ਜੀ ਹਾਂ ਇਨ੍ਹਾਂ ਖੇਤਰ ਵਿੱਚ ਵਿਦਿਆਰਥੀ ਸਕੂਲਾਂ ਵਿੱਚ ਦੌੜਨ ਵਿੱਚ ਰੁੱਝੇ ਹੋਏ ਹਨ ਛੋਟੇ ਬੱਚਿਆਂ ਦਾ ਸਹਿਮਤ ਰਹਿਣ ਲਈ ਸਿਹਤ ਅਤੇ ਸਿਹਤ ਵੱਲ ਧਿਆਨ ਦੇਣ ਲਈ ਇਹ ਸਹੀ ਤਰੀਕਾ ਹੈ ਅਤੇ ਨਿਯਮਤ ਵਿਦਯਾਮ ਵੀ ਵਿਯਾਮ ਵੀ ਜ਼ਰੂਰੀ ਹੈ ਛੋਟੇ ਬੱਚਿਆਂ ਨੂੰ ਸਿਹਤਮੰਦ ਰਹਿਣ ਲਈ ਮਦਦ ਕਰਨ ਲਈ ਇਹ ਵੀ ਉੱਚਿਤ ਹੋ ਜਾ ਓ ਉੱਚਿਤ ਹੋ ਸਕਦਾ ਹੈ ਕਿ ਤੁਹਾਨੂੰ ਉਹਨਾਂ ਦੀ ਮਾਨਸਿਕ ਅਤੇ ਸਰੀਰਿਕ ਤਰੱਕੀ ਨੂੰ ਸਮਝਣ ਲਈ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਦੀ ਤਰੱਕੀ ਨੂੰ ਪ੍ਰੀਖਿਆ ਅਤੇ ਉਹਨਾਂ ਨੂੰ ਉੱਤਮ ਸਿਹਤ ਦਾ ਰੀਕ੍ਰਮ ਕਰਨ ਲਈ ਨਿਯਮਤ ਚੈੱਕਅਪ ਕਰਵਾਉਣ ਲਈ ਕਰ ਇਸ ਤੋਂ ਬਾਅਦ ਸਿਹਤਮੰਦ ਖੁਰਾਕ ਅਤੇ ਪਾਣੀ ਦੀ ਅਦਰਮਾਈ ਆਦਮਕ ਮਿੱਤਰਾ ਮਾਤਰਾ ਨੂੰ ਲਾਈ ਸਹੀ ਨੀਂਹਾਂ ਅਤੇ ਸਵੱਛਤਾ ਦੇ ਨਿਯਮ ਨਿਯਮ ਅਤੇ ਅਨੁਸਾਰ ਨੂੰ ਅਮਲ ਕਰਨ ਨੂੰ ਬੱਚਿਆ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ ਸਿਹਤਮੰਦ ਰਹਿਣ ਲਈ ਮਦਦ ਕਰਦਾ ਹੈ ਛੋਟੇ ਬੱਚਿਆਂ ਸਬਜ਼ੀਆਂ ਫਲਾਂ ਫਰੂਟ ਸਭ ਕੁਛ ਖਾਣਾ ਚਾਹੀਦਾ ਹੈ ਉਹ ਉਹਨਾਂ ਨੂੰ ਸਵਸਤਮੰਦ ਬਣਾਉਂਦੀ ਹੈ ਇਹ ਖੁਰਾਕ ਦੇਣੀ ਚਾਹੀਦੀ ਹੈ ਉਹਨਾਂ ਨੂੰ ਹਮੇਸ਼ਾ ਚੰਗੀ ਖੁਰਾਕ ਦੇਣੀ ਚਾਹੀਦੀ ਹੈ ਜਿਸ ਕਰਕੇ ਉਹ ਸਕੂਲ ਵਿੱਚ ਵੀ ਸਹੀ ਪਰ ਸਹੀ ਪਰਫੋਰਮ ਕਰ ਸਕਣ ਅਤੇ ਆਪਣਾ ਨਾਮ ਵਧੀਆ ਕਰ ਸਕਣ ਅਤੇ ਪੜ੍ਹਾਈ ਵਿੱਚ ਵੀ ਰੁਚੀ ਰੱਖ ਸਕਣ ਅਤੇ ਵਿੱਚ ਉਹਨਾਂ ਨਾਲ ਨਿਯਮਿਤ ਵੀਯਾਮ ਕਰਵਾਉਣਾ ਅਤੇ ਨੀਹਾਂ ਦੀ ਸਵੱਛਤਾ ਲਾਗੂ ਕਰਨਾ ਹੈ ਅੱਜ ਕੱਲ੍ਹ ਵੱਡੇ ਵੱਡੇ ਸਕੂਲਾਂ ਵਿੱਚ ਵੀ ਖੇਡਾਂ ਨੂੰ ਮਹੱਤਤਾ ਦਿੱਤੀ ਗਈ ਹੈ ਅਤੇ ਬੱਚਿਆਂ ਨੂੰ ਫਿੱਟ ਰੱਖਣ ਲਈ ਵੀ ਕਈ ਗਰੁੱਪ ਬਣਾਏ ਗਏ ਹਨ ਜਿਸ ਨਾਲ ਬੱਚੇ ਚੰਗੀ ਤਰ੍ਹਾਂ ਖੇਡ ਸਕਣ ਅਤੇ ਜਿਨ੍ਹਾਂ ਨੂੰ ਖੇਡਾਂ ਵਿੱਚ ਇੰਟਰਸਟ ਹੈ ਉਹ ਚੰਗੀ ਤਰ੍ਹਾਂ ਮੈਡਲ ਵੀ ਲਿਆ ਸਕਣ ਅਤੇ ਆਪਣੇ ਦੇਸ਼ ਦਾ ਨਾਮ ਵੀ ਰੌਸ਼ਨ ਕਰ ਸਕਣ